ਜਿਵੇਂ ਕਿ ਤੁਸੀਂ ਦੇਖਦੇ ਹੀ ਹੋ ਜੇ ਅਸੀਂ ਪੰਜਾਬ ਦੇ ਖੇਤਰ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸਾਰੇ ਹੀ ਪੰਛੀ ਆਉਂਦੇ ਹਨ ਜਿਹੜੇ ਕਿ ਸਾਡੇ ਮਨ ਨੂੰ ਮਾਹ ਮੋਹ ਲੈਂਦੇ ਹਨ ਇਹਨਾਂ ਪੰਛੀਆਂ ਦੇ ਵਿੱਚੋਂ ਕਾਂ ਕਬੂਤਰ ਤੋਤਾ ਚਿੜੀ ਇੱਲ ਇਹ ਸਾਰੇ ਆਉਂਦੇ ਹਨ ਅਤੇ ਮੇਰਾ ਮਨਪਸੰਦੀਦਾ ਪੰਛੀ ਤੋਤਾ ਹੈ ਇਹ ਇਸ ਲਈ ਹੈ ਕਿਉਂਕਿ ਮੈਨੂੰ ਉਹ ਦੇਖਣ ਦੇ ਵਿੱਚ ਹੀ ਬਹੁਤ ਸੋਹਣਾ ਲੱਗਦਾ ਹੈਗਾ ਜੇ ਅਸੀਂ ਉਹਨੂੰ ਆਪਣੇ ਘਰ ਦੇ ਵਿੱਚ ਰੱਖੀਏ ਤਾਂ ਉਹ ਸਾਡੇ ਵਾਂਗੂ ਹੀ ਬੋਲਦਾ ਹੈ ਜਿੱਦਾਂ ਅਸੀਂ ਗੱਲ ਕਰਦੇ ਹਾਂ ਬਿਲਕੁਲ ਉਸ ਤਰ੍ਹਾਂ ਹੀ ਗੱਲ ਕਰਦਾ ਹੈ ਜੇ ਅਸੀਂ ਉਸਨੂੰ ਕੁਛ ਪੁੱਛਦੇ ਹੈਗੇ ਹਾਂ ਤਾਂ ਉਹ ਆਪ ਜਿੱਦਾਂ ਹਿਊਮਨਸ ਆਪਣੇ ਦਿਮਾਗ ਦੀ ਵਰਤੋਂ ਕਰਕੇ ਆਨਸਰ ਦਿੰਦੇ ਹਨ ਇਸ ਤਰ੍ਹਾਂ ਹੀ ਉਹ ਦਿੰਦਾ ਹੈਗਾ ਆ ਜੇ ਪਹਿਲਾਂ ਅਸੀਂ ਆਪਣੇ ਘਰ ਦੇ ਵਿੱਚ ਇੱਕ ਤੋਤਾ ਰੱਖਿਆ ਹੋਇਆ ਸੀ ਜਿਹੜਾ ਕਿ ਉਹ ਸਾਡੇ ਘਰ ਦੇ ਸਾਰੇ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਨਾਮ ਲੈਂਦਾ ਹੁੰਦਾ ਸੀਗਾ ਅਤੇ ਉਹਨਾਂ ਦੇ ਨਾਲ ਗੱਲਾਂ ਕਰਦਾ ਹੁੰਦਾ ਸੀਗਾ ਉਸ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦਾ ਵੀ ਬਹੁਤ ਢੰਗ ਸੀਗਾ ਅਸੀਂ ਉਸ ਦੇ ਨਾਲ ਬਹੁਤ ਖੁਸ਼ ਸੀਗੇ ਅਤੇ ਉਹ ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਅਤੇ ਉਹ ਉਸ ਦੇ ਮੂੰਹ 'ਚੋਂ ਮੇਰਾ ਆਪ ਜਦੋਂ ਉਹ ਨਾਮ ਲੈਂਦਾ ਸੀਗਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀਗਾ ਜਦੋਂ ਉਸ ਜਦੋਂ ਮੈਂ ਸਵੇਰ ਨੂੰ ਉੱਠਦੀ ਸੀਗੀ ਤਾਂ ਉਹ ਮੈਨੂੰ ਸਵੇਰ ਨੂੰ ਗੁੱਡ ਮੋਰਨਿੰਗ ਵੀ ਕਹਿੰਦਾ ਹੁੰਦਾ ਸੀਗਾ ਅਤੇ ਕਹਿੰਦਾ ਹੁੰਦਾ ਸੀਗਾ ਨਿਸ਼ਾ ਜਲਦੀ ਜਲਦੀ ਉੱਠ ਜਾਓ ਅਤੇ ਫਿਰ ਆਪਣੇ ਕੰਮ 'ਤੇ ਜਾਓ ਨਾਲੇ ਪੜ੍ਹ ਲਉ ਪੜ੍ਹ ਲਉ ਅੱਗੇ ਜਾ ਕੇ ਪੜ੍ਹਨਾ ਹੀ ਕੰਮ ਆਉਣਾ ਹੈਗਾ ਆ ਉਹ ਮੈਨੂੰ ਸਵੇਰੇ ਸਵੇਰੇ ਇੱਦਾਂ ਕਹਿਣ ਲੱਗ ਜਾਂਦਾ ਸੀ